ਹਾਂਜੀ ਆਪਣੀ ਨਾ ਪਹਿਲਾਂ ਤਾਂ ਕੋਈ ਇੱਛਾ ਨਹੀਂ ਸੀਗੀ ਅਤੇ ਫਿਰ ਆਪਾਂ ਨੂੰ ਬਚਪਨ ਦੇ ਵਿੱਚ ਆਪਾਂ ਜਦੋਂ ਪੜ੍ਹਦੇ ਸੀ ਪੜ੍ਹਾਈ ਦੇ ਨਾਲ ਨਾਲ ਫਿਰ ਸਾਡੇ ਪਾਪਾ ਜੀ ਪੂਰੇ ਹੋ ਗਏ ਅਤੇ ਫਿਰ ਸਾਨੂੰ ਲੋੜ ਮਹਿਸੂਸ ਹੋਈ ਵੀ ਅਸੀਂ ਆਪ ਅਸੀਂ ਆਪਣੀ ਮੰਮੀ ਵੱਲ ਦੇਖਿਆ ਵੀ ਉਹ ਤੰਗ ਹੁੰਦੇ ਸੀਗੇ ਸਾਨੂੰ ਉਨ੍ਹਾਂ ਨੂੰ ਚਾਰ ਬੱਚੇ ਪਾਲਣੇ ਔਖੇ ਸੀ ਸਾਡੇ ਪਾਪਾ ਜੀ ਪੂਰੇ ਹੋ ਗਏ ਫਿਰ ਉਨ੍ਹਾਂ ਨੇ ਸਾਨੂੰ ਪੜ੍ਹਾਈ ਦੇ ਨਾਲ ਨਾਲ ਤਾਂ ਸਾਨੂੰ ਉਨ੍ਹਾਂ ਨੇ ਸਿਖਾਇਆ ਵੀ ਆਪਣਾ ਕੰਮ ਕੋਈ ਨਾਲ ਕਰਨਾ ਚਾਹੀਦਾ ਹੈ ਅਤੇ ਫਿਰ ਅਸੀਂ ਪੜ੍ਹਾਈ ਦੇ ਨਾਲ ਨਾਲ ਅਸੀਂ ਕਟਿੰਗ ਟੇਲਰਿੰਗ ਦੇ ਕੋਰਸ ਵਿੱਚ ਮੈਂ ਲੱਗੀ ਅਤੇ ਉੱਥੇ ਅਸੀਂ ਕਟਿੰਗ ਟੇਲਰਿੰਗ ਸਿੱਖੀ ਕਟਿੰਗ ਟੇਲਰਿੰਗ ਸਿੱਖ ਕੇ ਤਾਂ ਫਿਰ ਅਸੀਂ ਆਪਣਾ ਪ੍ਰਾਈਵੇਟ ਕੰਮ ਕੀਤਾ ਸਿਲਾਈ ਕਟਾਈ ਦਾ ਅਸੀਂ ਆਪਣਾ ਬੂਟੀਕ ਦਾ ਕੰਮ ਵਧੀਆ ਚਲਾਇਆ ਜੇ ਅਸੀਂ ਇਹ ਚਲਾਉਂਦੇ ਹਾਂ ਤਾਂ ਫਿਰ ਇਹਦੇ ਨਾਲ ਸਾਡਾ ਇੰਝ ਹੈ ਵੀ ਅਸੀਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵਧੀਆ ਕਰ ਸਕਦੇ ਅੱਗੇ ਜਾ ਕੇ ਅਸੀਂ ਇੰਡੀਪੈਂਡੈਂਟ ਬਣਾਂਗੇ ਆਪਣੇ ਪੈਰਾਂ 'ਤੇ ਖੜੇ ਹੋਵਾਂਗੇ ਅਤੇ ਫਿਰ ਇੱਕ ਸਾਲ ਅਸੀਂ ਕਟਿੰਗ ਟੇਲਰਿੰਗ ਦੇ ਵਿੱਚ ਲਾਇਆ ਸਾਰਾ ਕੰਮ ਕਾਰ ਸਿੱਖਿਆ ਅਤੇ ਇਹ ਸੋਚ ਕੇ ਫਿਰ ਅਸੀਂ ਅੱਗੇ ਇੱਕ ਸਾਲ ਦਾ ਹੋਰ ਕੋਰਸ ਕੀਤਾ ਅਤੇ ਫਿਰ ਅਸੀਂ ਹੌਜਰੀ ਦੋ ਸਾਲ ਦਾ ਕੋਰਸ ਸੀਗਾ ਇਹ ਹੋਜਰੀ ਦੇ ਵਿੱਚ ਅਸੀਂ ਆਪਣਾ ਕੋਟੀਆਂ ਸੁਐਟਰ ਮਸ਼ੀਨਾਂ 'ਤੇ ਬਣਾਏ ਹੱਥ 'ਤੇ ਬਣਾਏ ਫਿਰ ਉੱਥੇ ਅਸੀਂ ਮਸ਼ੀਨੀ ਜ਼ੁਰਾਬਾਂ ਬਣਾਉਣੀਆਂ ਸਿੱਖੀਆਂ ਮਸ਼ੀਨਾਂ 'ਤੇ ਬੰਦ ਬਣਾਏ ਅਤੇ ਇਹਦੇ ਵਿੱਚ ਅਸੀਂ ਇੰਡੀਪੈਂਡੈਂਟ ਹੋ ਸਕਦੇ ਸੀ ਅੱਗੇ ਜਾ ਕੇ ਅਸੀਂ ਇਹਦੇ ਵਿੱਚ ਵੀ ਅਸੀਂ ਆਪਣਾ ਕਾਰੋਬਾਰ ਖੋਲ੍ਹ ਕੇ ਅਸੀਂ ਆਪਣਾ ਪਰਿਵਾਰ ਵਧੀਆ ਚਲਾ ਸਕਦੇ ਸੀਗੇ ਅਤੇ ਹੋਰ ਵੀ ਅਸੀਂ ਇਸ ਕਾਰੋਬਾਰ ਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਨੂੰ ਸਿਖਾ ਕੇ ਅਸੀਂ ਆਪਣਾ ਘਰ ਦੇ ਕੰਮ ਦੇ ਨਾਲ ਨਾਲ ਵੀ ਕਰ ਸਕਦੇ ਸੀ ਅਤੇ ਇਹਦੇ ਵਿੱਚ ਅਸੀਂ ਫਿਰ ਟੀਚਰ ਟਰੇਨਿੰਗ ਵੀ ਆਉਂਦੀ ਹੈ ਟੀਚਰ ਟਰੇਨਿੰਗ ਦੇ ਵਿੱਚ ਅਸੀਂ ਸਾਨੂੰ ਸਰਕਾਰੀ ਜੋਬ ਦੀ ਓਫਰ ਵੀ ਹੋਏ ਸੀਗੇ ਪਰ ਸਾਨੂੰ ਪਰਿਵਾਰ ਦੇ ਵਿੱਚ ਜੋਬ ਕਰਨੀ ਨਹੀਂ ਮਿਲੀ ਸਾਡੇ ਪਰਿਵਾਰ ਦੇ ਵਿੱਚ ਇੱਦਾਂ ਦੇ ਹਲਾਤ ਸੀਗੇ ਤਾਂ ਵਿਆਹ ਤੋਂ ਮਗਰੋਂ ਫਿਰ ਇਸ ਕਰਕੇ ਫਿਰ ਮੈਂ ਆਪਣਾ ਪ੍ਰਾਈਵੇਟ ਘਰ ਕੰਮ ਕੀਤਾ ਘਰ ਕੰਮ ਕੀਤਾ ਅਤੇ ਆਪਣੀ ਕਟਿੰਗ ਟੇਲਰਿੰਗ ਦਾ ਕੰਮ ਵੀ ਕੀਤਾ ਨਾਲ ਨਾਲ ਅਸੀਂ ਹੋਜਰੀ ਦਾ ਕੰਮ ਵੀ ਕੀਤਾ ਅਤੇ ਆਪਣੇ ਪਰਿਵਾਰ ਨੂੰ ਇੱਕ ਬਹੁਤ ਵਧੀਆ ਜੀਵਨ ਅੱਜ ਮੈਂ ਦੇ ਰਹੀ ਹਾਂ ਅਤੇ ਅੱਗੇ ਜਾ ਕੇ ਵੀ ਅੱਗੇ ਜਾ ਕੇ ਵੀ ਹੁਣ ਮੇਰੇ ਪਰਿਵਾਰ ਸਾਰਾ ਆਪੋ ਆਪਣੇ ਪੈਰਾਂ 'ਤੇ ਖੜ੍ਹਾ ਹੈ ਅਤੇ ਇਸ ਤਰ੍ਹਾਂ ਅਸੀਂ ਇੱਛਾਵਾਂ ਸਾਡੀਆਂ ਹੋਰ ਰੋਜ਼ ਦਿਨੋਂ ਦਿਨ ਵਧਦੀਆਂ ਜਾਂਦੀਆਂ ਹੈ ਅਤੇ ਬੱਚੇ ਵਧੀਆ ਸੈੱਟ ਆ ਅਤੇ ਬਹੁਤ ਬਹੁਤ ਧੰਨਵਾਦ ਜੀ